ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਗੱਡੀ ਦੀ ਸਰਵਿਸ ਆ ਗਈ ਗੱਡੀ ਦੀ ਸਰਵਿਸ ਕਰਵਾਉਣੀ ਸੀ ਭਾਅ ਜੀ ਪ੍ਰੋਬਲਮ ਤਾਂ ਹੈਗੀ ਆ ਕਿ ਜਦੋਂ ਮੈਂ ਬ੍ਰੇਕ ਲਾਉਂਦਾ ਨਾ ਤਾਂ ਟੈਰ 'ਚ ਨਾ ਆਵਾਜ਼ ਜਿਹੀ ਆਉਂਦੀ ਆ ਅਤੇ ਪਿੱਛੇ ਜਿਹੇ ਮੁੰਡੇ ਨੇ ਨਾ ਗੱਡੀ ਠੋਕ ਤੀ ਸੀ ਅਤੇ ਬੰਪਰ ਥੱਲੇ ਲੱਗ ਗਏ ਉਹਦੇ ਭਾਅ ਜੀ ਖਰਚੇ ਦੀ ਟੈਂਸ਼ਨ ਨਾ ਲਓ ਤੁਸੀਂ ਬਸ ਗੱਡੀ ਤੁਹਾਨੂੰ ਪਤਾ ਹੀ ਤੁਹਾਡਾ ਪੁਰਾਣਾ ਗਾਹਕ ਹੈ ਚੰਗੀ ਸਰਵਿਸ ਕਰਕੇ ਦਿਓ ਅਤੇ ਰਿਪੇਅਰ ਚੰਗੀ ਕਰਕੇ ਦੱਸਿਓ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਤੁਸੀਂ ਟਾਈਮ ਦੱਸ ਦਿਓ ਕਦੋਂ ਤੱਕ ਤੁਸੀਂ ਫਰੀ ਹੋਣਾ ਕੋਈ ਗੱਡੀ ਤਾਂ ਨਹੀਂ ਖਲੋਤੀ ਤੁਹਾਡੇ ਗਰੇਜ 'ਚ ਓਕੇ ਭਾਅ ਜੀ ਮੈਂ ਅੱਧੇ ਘੰਟੇ ਦੇ ਵਿਚਕਾਰ ਵਿਚਕਾਰ ਆ ਜਾਂਦਾ ਚਲੋ ਠੀਕ ਆ ਧੰਨਵਾਦ ਭਾਅ ਜੀ